ਹਾਂ ਇਹ ਗੱਲ ਬਿਲਕੁਲ ਸਹੀ ਹੈ ਕਿ ਭਾਰਤ ਵਿੱਚ ਕਲਾਕਾਰਾਂ ਨੂੰ ਲੋੜੀਂਦਾ ਮਹੱਤਵ ਅਤੇ ਮੌਕੇ ਨਹੀਂ ਦਿੱਤੇ ਜਾਂਦੇ ਭਾਰਤ ਵਿੱਚ ਕਲਾਕਾਰਾਂ ਦੀ ਕਮੀ ਨਹੀਂ ਹੈ ਭਾਰਤ ਵਿੱਚ ਗਰੀਬ ਕਲਾਕਾਰ ਵੀ ਹੁੰਦੇ ਹਨ ਅਤੇ ਅਮੀਰ ਕਲਾਕਾਰ ਵੀ ਹੁੰਦੇ ਹਨ ਅਮੀਰ ਕਲਾਕਾਰ ਤਾਂ ਆਪਣੇ ਉਸਤਾਦ ਕੋਲੋਂ ਸਿੱਖ ਕੇ ਚੰਗਾ ਪੜ੍ਹ ਲਿਖ ਕੇ ਵਧੀਆ ਆਪਣੀ ਕਲਾਕਾਰੀ ਦਿਖਾ ਦਿੰਦੇ ਹਨ ਪਰ ਗਰੀਬ ਕਲਾਕਾਰ ਜੋ ਹੁੰਦੇ ਹਨ ਉਹਨਾਂ ਨੂੰ ਇਹੋ ਜਿਹੇ ਮੌਕੇ ਨਹੀਂ ਮਿਲਦੇ ਉਹਨਾਂ ਕੋਲ ਜਾਣ ਦੀ ਕੋਈ ਵੀ ਸੰਪੱਤੀ ਨਹੀਂ ਹੁੰਦੀ ਉਹ ਆਪਣਾ ਕਲਾਕਾਰੀ ਕਿਸੇ ਨੂੰ ਨਹੀਂ ਦਿਖਾ ਸਕਦੇ ਉਹਨਾਂ ਨੂੰ ਦਿਖਾਉਣ ਵਾਸਤੇ ਬਹੁਤ ਚੀਜ਼ਾਂ ਦੀ ਜ਼ਰੂਰਤ ਪੈਂਦੀ ਹੈ ਕਈ ਚੰਗੇ ਕਲਾਕਾਰ ਹਨ ਜਿਨ੍ਹਾਂ ਨੂੰ ਇਹ ਮੌਕਾ ਨਹੀਂ ਮਿਲ ਪਾਉਂਦਾ ਅਤੇ ਉਹ ਨਹੀਂ ਜਾ ਪਾਉਂਦੇ ਸਰਕਾਰ ਨੂੰ ਚਾਹੀਦਾ ਹੈ ਕਿ ਇਹਨਾਂ ਨੂੰ ਆਪਣੀ ਕਲਾਕਾਰੀ ਦਿਖਾਉਣ ਵਾਸਤੇ ਕੋਈ ਕਈ ਚੀਜ਼ਾਂ ਪ੍ਰਦਾਨ ਕਰਨੀਆਂ ਚਾਹੀਦੀਆਂ ਹਨ ਗਰੀਬ ਕਲਾਕਾਰ ਵਿਚਾਰਾ ਇੱਦਾਂ ਹੀ ਰਹਿ ਜਾਂਦਾ ਹੈ ਅਤੇ ਅਮੀਰ ਆਪਣਾ ਸਿੱਖ ਕੇ ਚੰਗਾ ਕੰਮ ਕਰਕੇ ਆਪਣੀ ਕਲਾਕਾਰੀ ਦਿਖਾ ਦਿੰਦਾ ਹੈ ਅਤੇ ਸਰਕਾਰ ਨੂੰ ਚਾਹੀਦਾ ਹੈ ਕਿ ਗਰੀਬ ਦੇ ਵਾਸਤੇ ਵੀ ਕਈ ਰਸਤੇ ਖੋਲ੍ਹੇ ਜਾਣ